ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅੱਜ ਪੰਜਾਬੀ ਭਾਸ਼ਾ ਬਹੁਤ ਹੀ ਵੱਡੇ ਪੈਮਾਨੇ 'ਤੇ ਬੋਲੀ ਜਾ ਰਹੀ ਹੈ ਅੱਜ ਪੰਜਾਬੀ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਵਸੇ ਹੋਏ ਹਨ ਅਤੇ ਦੁਨੀਆਂ ਦੇ ਵੱਖ ਵੱਖ ਕੋਨਿਆਂ ਵਿੱਚ ਪੰਜਾਬੀ ਬੋਲੀ ਜਾ ਰਹੀ ਹੈ ਪੰਜਾਬੀ ਭਾਸ਼ਾ ਇੰਨਾਂ ਫ ਇੰਨਾਂ ਫੈਲ ਚੁੱਕੀ ਹੈ ਕਿ ਹਰ ਕੋਈ ਪੰਜਾਬੀ ਨੂੰ ਸਮਝ ਸਕਦਾ ਹੈ ਪਰ ਅੱਜ ਕੁਝ ਖਾਮੀਆਂ ਹਨ ਜੋ ਪੰਜਾਬੀ ਵਿੱਚ ਦਿਨ ਬ ਦਿਨ ਵੱਧ ਰਹੀਆਂ ਹਨ ਪੰਜਾਬੀ ਭਾਸ਼ਾ ਵਿੱਚ ਬਾਹਰਲੀਆਂ ਭਾਸ਼ਾ ਆ ਕੇ ਮਿਲ ਰਹੀਆਂ ਹਨ ਅਤੇ ਇਹਨਾਂ ਦੇ ਕੁਝ ਸ਼ਬਦ ਅਲੋਪ ਹੋ ਰਹੇ ਹਨ ਅੱਜ ਕੱਲ੍ਹ ਆਪਣੇ ਬੱਚੇ ਕੋਂਨਵੈਂਟ ਸਕੂਲਾਂ ਵਿੱਚ ਪੜ੍ਹਦੇ ਹਨ ਜਿੱਥੇ ਕਿ ਪੰਜਾਬੀ ਬੋਲਣ 'ਤੇ ਰੋਕ ਲਾਈ ਜਾਂਦੀ ਹੈ ਇਹ ਇਹ ਜਰਾ ਸਰ ਪੰਜਾਬੀ ਭਾਸ਼ਾ ਖਤਮ ਹੋਣ ਦੇ ਕਿਨਾਰੇ 'ਤੇ ਆ ਸਕਦੀ ਹੈ ਜਿਸ ਨਾਲ ਅਸੀਂ ਪੰਜਾਬੀ ਦੀ ਹੋਂਦ ਭੁੱਲ ਸਕਦੇ ਹਾਂ ਅਤੇ ਪੰਜਾਬੀ ਦੂਜੀਆਂ ਭਾਸ਼ਾ ਵਾਂਗ ਇੱਕੋ ਜਿਹੀ ਭਾਸ਼ਾ ਲੱਗੇ ਲੱਗਣ ਲੱਗ ਸਕਦੀ ਹੈ ਪੰਜਾਬੀ ਭਾਸ਼ਾ ਇੱਕ ਵੱਖਰੀ ਭਾਸ਼ਾ ਹੈ ਇਸ ਦੇ ਸ਼ਬਦ ਕਠੋਰ ਹਨ ਅਤੇ ਇਸ ਦੇ ਅਲੋਪ ਸ਼ਬਦਾਂ ਨੂੰ ਆਪਾਂ ਨੂੰ ਦੁਬਾਰਾ ਸਰ ਸਰਜੀਵਿਤ ਕਰਨ ਦੀ ਲੋੜ ਹੈ ਸਾਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੇ ਕੁਝ ਸ਼ਬਦ ਸਿਖਾਏ ਜਾਣ ਜੋ ਕਿ ਅੱਜ ਕੱਲ੍ਹ ਅਲੋਪ ਹਨ ਆਪਾਂ ਪੰਜਾਬੀ ਭਾਸ਼ਾ ਡੁੱਬਣ ਤੋਂ ਬਚਾਉਣੀ ਚਾਹੀਦੀ ਹੈ ਆਪਾਂ ਨੂੰ ਪ ਭਾਸ਼ਾ ਨੂੰ ਚਾਹੀਦਾ ਹੈ ਕਿ ਭਾਸ਼ਾ ਨੂੰ ਆਪਾਂ ਮੁੜ ਤੋਂ ਸਜੀਵ ਅਤੇ ਸੋਹਣੀ ਬਣਾ ਸਕੀਏ ਪੰਜਾਬੀ ਭਾਸ਼ਾ ਵਿੱਚ ਜਿਹੜੇ ਦੂਸਰੇ ਸ਼ਬਦ ਰਲ ਰਹੇ ਹਨ ਆਪਾਂ ਨੂੰ ਉਹਨਾਂ ਨੂੰ ਵੰਡ ਕਰਨ ਦੀ ਜ਼ਰੂਰਤ ਹੈ ਆਪਾਂ ਆਪਣੇ ਰੋਜ਼ਾਨਾ ਰੋਜ਼ਾਨਾ